ਮੋਹਾਲੀ ਸ਼ਹਿਰ ਪੰਜਾਬ ਦਾ ਇੱਕ ਬਹੁਤ ਹੀ ਵੱਡਾ ਜ਼ਿਲ੍ਹਾ ਹੈ ਇੱਥੇ ਬਹੁਤ ਹੀ ਅਲੱਗ ਅਲੱਗ ਤਰ੍ਹਾਂ ਦੇ ਘੁੰਮਣ ਨੂੰ ਜਗ੍ਹਾਵਾਂ ਹਨ ਜਿਵੇਂ ਕਿ ਐੱਲ ਐੱਨ ਸੀ ਐੱਮ ਮਾਲ ਪਾਰਕਾਂ ਨੇ ਅਤੇ ਪਾਰਕਾਂ ਨੇ ਕਲੱਬਸ ਨੇ ਜਿੱਥੇ ਲੋਕ ਇਕੱਠੇ ਹੁੰਦੇ ਨੇ ਅਤੇ ਇੱਥੇ ਬਹੁਤ ਮਾਰਕਿਟਜ਼ ਨੇ ਜਿੱਥੇ ਲੋਕ ਖਰੀਦਦਾਰੀ ਕਰਨ ਆਉਂਦੇ ਨੇ ਮੋਹਾਲੀ ਸ਼ਹਿਰ ਦੇ ਵਿੱਚ ਇੱਕ ਕ੍ਰਿਕਟ ਸਟੇਡੀਅਮ ਵੀ ਹੈ ਜਿੱਥੇ ਕਿ ਆਈ ਪੀ ਐੱਲ ਦੇ ਮੈਚਿਜ਼ ਹੁੰਦੇ ਹਰ ਸਾਲ ਮੈਚ ਹੁੰਦੇ ਹਨ ਇੱਕ ਗਰਾਊਂਡ ਅਲੱਗ ਤੋਂ ਬਹੁਤ ਬੜਾ ਬਣਾਇਆ ਹੋ ਗਿਆ ਹੈ ਬਣਾਇਆ ਮੋਹਾਲੀ ਸ਼ਹਿਰ ਜਿੱਥੇ ਕਿ ਕਬੱਡੀ ਦੇ ਮੈਚ ਦੌੜਾਂ ਹੁੰਦੀਆਂ ਹਨ ਹਰ ਸਾਲ ਜੂਡੋ ਕਰਾਟੇ ਕਰਾਟੇ ਖਲਾਏ ਜਾਂਦੇ ਨੇ ਵਾਲੀਵਾਲ ਦੇ ਮੈਚ ਹੁੰਦੇ ਹਨ ਇਹ ਏਅਰਪੋਰਟ ਰੋਡ 'ਤੇ ਸਥਿਤ ਹੈ ਗਰਾਊਂਡ ਇੱਥੇ ਆਈ ਆਈ ਟੀ ਆਈ ਆਈ ਟੀ ਆਰ ਇੱਕ ਜਿਹਾ ਸਕੂਲ ਵੀ ਹੈ ਜੋ ਕਿ ਬਹੁਤ ਹੀ ਬੜਾ ਅਤੇ ਬਹੁਤ ਹੀ ਚੰਗਾ ਹੈ ਮਤਲਬ ਦੂਰੋਂ ਦੂਰੋਂ ਇੱਥੇ ਵਿਦਿਆਰਥੀ ਪੜ੍ਹਨ ਆਉਂਦੇ ਹਨ ਇਹ ਮੋਹਾਲੀ ਦਾ ਏਅਰਪੋਰਟ ਬਹੁਤ ਹੀ ਮਸ਼ਹੂਰ ਹੈ ਇੱਥੇ ਇ ਇੱਥੋਂ ਦਿੱਲੀ ਅੰਮ੍ਰਿਤਸਰ ਦੀਆਂ ਫਲਾਈਟਜ਼ ਚੱਲਦੀਆਂ ਜਾਂਦੀਆਂ ਨੇ ਅਤੇ ਦੁਬਈ ਦੀਆਂ ਡਾਈਰੈਕਟ ਫਲਾਈਟਾਂ ਇੱਥੋਂ ਹੁਣ ਸ਼ੁਰੂ ਹੋ ਚੁੱਕੀਆਂ ਹਨ ਏਅਰਪੋਰਟ ਤੋਂ ਇੱਥੇ ਇਤਿਹਾਸਿਕ ਅਸਥਾਨਾਂ ਦੇ ਵਿੱਚ ਅੰਬ ਸਾਹਿਬ ਗੁਰਦੁਆਰਾ ਸਾਹਿਬ ਸੋਹਾਣਾ ਸਾਹਿਬ ਸਿੰਘ ਸ਼ਹੀਦਾਂ ਗੁਰਦੁਆਰਾ ਸਾਹਿਬ ਸ਼ਾਮਿਲ ਹੈ ਅਤੇ ਉੱਥੋਂ ਦੂਰ ਦੂਰ ਤੋਂ ਸੰਗਤਾਂ ਇੱਥੇ ਦਰਸ਼ਨ ਕਰਨ ਆਉਂਦੀਆਂ ਨੇ ਅਲੱਗ ਅਲੱਗ ਜ਼ਿਲ੍ਹਿਆਂ ਤੋਂ ਪੰਜਾਬ ਤੋਂ ਸਟੇਟਾਂ ਤੋਂ ਦਰਸ਼ਨ ਕਰਨ ਇੱਥੇ ਸੰਗਤਾਂ ਆਉਂਦੀਆਂ ਹਨ ਅਤੇ ਐਨ ਸੀ ਐੱਮ ਮਾਲ ਦੇ ਵਿੱਚ ਮੂਵੀਜ਼ ਲੱਗਦੀਆਂ ਨੇ ਖਰੀਦਦਾਰੀ ਲਈ ਲੋਕ ਆਉਂਦੇ ਹਨ ਅਤੇ ਫਨ ਫ ਇੰਨਜੋਏ ਕਰਨ ਦੁਨੀਆਂ ਆਉਂਦੀ ਇੱਥੇ ਆਉਂਦੀ ਹੈ ਅਤੇ ਹਾਂ ਸੜਕਾਂ ਤਾਂ ਮੋਹਾਲੀ ਸ਼ਹਿਰ ਦੀਆਂ ਸੜਕਾਂ ਬਹੁਤ ਹੀ ਵਧੀਆ ਹਨ ਪ੍ਰਬੰਧ ਬਹੁਤ ਵਧੀਆ ਇੱਥੇ ਪਾਰਕਾਂ ਬਹੁਤ ਹੀ ਸਾਫ਼ ਸੁਥਰੀਆਂ ਹਨ ਇੱਥੇ ਬੱਚੇ ਸ਼ਾਮ ਨੂੰ ਆਰਾਮ ਇਜ਼ੀ ਆਰਾਮ ਨਾਲ ਖੇਲਣ ਖੇਲਦੇ ਹਨ ਬਜ਼ੁਰਗ ਸਵੇ ਸਵੇਰੇ ਸ਼ਾਮ ਇੱਥੇ ਪਾਰਕਾਂ ਵਿੱਚ ਸੈਰ ਕਰਨ ਆਉਂਦੇ ਹਨ ਮੋਹਾਲੀ ਦੇ ਪ੍ਰਬੰਧਕਾਂ ਨੇ ਇ ਪਾਰਕਾਂ ਸੜਕਾਂ ਗਲੀ ਮਹੱਲੇ ਬਹੁਤ ਹੀ ਸਾਫ਼ ਸੁਥਰੇ ਅਤੇ ਵਧੀਆ ਤਰ੍ਹਾਂ ਬਣਾ ਕੇ ਰੱਖੇ ਹੋਏ ਹਨ ਇੱਥੇ ਰਹਿ ਘਰਾਂ ਕੋਲਜਿਸ ਕਾ ਕਾਲਜ ਹਨ ਸਰਕਾਰੀ ਕੋਲਜ ਮੋਹਾਲੀ ਵਿੱਚ ਹੈ ਸਰਕਾਰੀ ਹਸਪਿਟ ਹਸ ਹਸਪਤਾਲ ਮੋਹਾਲੀ ਦੇ ਵਿੱਚ ਹੈ ਇੱਕ ਪ੍ਰਾਈਵੇਟ ਹੋਸਪੀਟਲ ਬਹੁਤ ਮਸ਼ਹੂਰ ਨੇ ਇੱਥੇ ਮੈ ਮੈਕਸ ਹੋਸਪੀਟਲ ਅਤੇ ਪ ਫੌਰਟੀਜ਼ ਹੋਸਪੀਟਲ ਵੀ ਹੈ ਜਿੱਥੇ ਕਿ ਹਰ ਤਰ੍ਹਾਂ ਦਾ ਇਲਾਜ ਮੌਜੂਦ ਹੈ ਇੱਥੇ ਦੂਰੋਂ ਦੂਰੋਂ ਲੋਕ ਇਲਾਜ ਇਲਾਜ ਕਰਨ ਆ ਆਉਂਦੇ ਹਨ ਖੇਡਾਂ ਦੇ ਵਿੱਚ ਮੋਹਾਲੀ ਜ਼ਿਲ੍ਹਾ ਪੰਜਾਬ ਦੇ ਵਿੱਚ ਕਾਫ਼ੀ ਉੱਪਰ ਹੈ ਇੱਥੇ ਹਰ ਤਰ੍ਹਾਂ ਦੀਆਂ ਖੇਡਾਂ ਖਿਡਾਈਆਂ ਜਾਂਦੀਆਂ ਹਨ ਹਰ ਤਰ੍ਹਾਂ ਦੇ ਕੋ ਕੋਚ ਹਨ ਇੱਥੋਂ ਦੀ ਵਿਦਾਨ ਗਗਨ ਮ ਅਨਮੋਲ ਮਾਨਕ ਹੈ ਮਾਨ ਹੈ ਉਸਨੇ ਬਹੁ ਇਸ ਨੂੰ ਮੋਹਾਲੀ ਜ਼ਿਲ੍ਹੇ ਨੂੰ ਉੱਪਰ ਚੁੱਕਣ ਦੇ ਲਈ ਬਹੁਤ ਹੀ ਉਪਰਾਲੇ ਕੀਤੇ ਹੈ ਉਪਰਾਲੇ ਕਰ ਰਹੀ ਹੈ ਅਤੇ ਖਰੜ ਸ਼ਹਿਰ ਇਸਦੇ ਨੇੜੇ ਹੈ ਉੱਥੇ ਵੀ ਉੱਥੇ ਵੀ ਬਹੁਤ ਹੀ ਰਹਿਣ ਲਈ ਫਲੈਟਸ ਬਣਾਏ ਗਏ ਹਨ ਤਾਂ ਜੋ ਲੋਕਾਂ ਨੂੰ ਰਹਿਣ ਲਈ ਵਧੀਆ ਅਤੇ ਚੰਗੀ ਜਗ੍ਹਾ ਮਿਲ ਸਕੇ ਅਤੇ ਸਸਤੀ ਜਗ੍ਹਾ ਮਿਲ ਸਕੇ ਇੱਥੇ ਦੂਰੋਂ ਦੂਰੋਂ ਵਿਦਿਆਰਥੀ ਰਹਿਣ ਆਉਂਦੇ ਪੜ੍ਹਨ ਲਈ ਆਉਂਦੇ ਨੇ ਅਤੇ ਰਹਿਣ ਲਈ ਆਉਂਦੇ ਨੇ ਅਤੇ ਇਹ ਇਹ ਘਰਾਂ ਵਿੱਚ ਇਜ਼ਿਲੀ ਮ ਮਤਲਬ ਕਿ ਰਹਿ ਸਕਦੇ ਹਨ ਕਿਉਂਕਿ ਇੱਥੋਂ ਇਹ ਇੱਥੇ ਕਿਰਾਇਆ ਵੀ ਬਹੁਤ ਘੱਟ ਹੈ ਚੰਡੀਗੜ੍ਹ ਦੇ ਮੁਕਾਬਲੇ ਇਸ ਲਈ ਮੋਹਾਲੀ ਜ਼ਿਲ੍ਹਾ ਬਹੁਤ ਹੀ ਵਧੀਆ ਅਤੇ ਸਾਫ਼ ਸੁਥਰਾ ਸ਼ ਜ਼ਿਲ੍ਹਾ ਹੈ